ਜੇ ਡਾਂਸ ਦੀ ਗੱਲ ਕਰੀਏ ਤਾਂ ਪੰਜਾਬ ਤਾਂ ਸਪੈਸ਼ਲੀ ਜੇ ਆਪਾਂ ਇੰਡੀਆ 'ਚ ਗੱਲ ਕਰੀਏ ਤਾਂ ਕਈ ਤਰੀਕੇ ਦੇ ਸ਼ੋਅਸ ਆਉਂਦੇ ਸੀ ਜਿਵੇਂ ਡੀ ਆਈ ਡੀ ਡਾਂਸ ਇੰਡੀਆ ਡਾਂਸ ਅਤੇ ਇੰਡੀਆ ਗੋਟ ਟੇਲੇਂਟ ਹੈ ਇਹੋ ਜਿਹੇ ਕਈ ਸਾਰੇ ਸ਼ੋਅ ਆਉਂਦੇ ਸੀ ਜਿੰਨ੍ਹਾਂ ਵਿੱਚ ਨਾਚ ਅਤੇ ਉਹਦੇ ਸੰਬੰਧ ਤੋਂ ਜਿਹੜੀ ਗਤੀਵਿਧੀਆਂ ਗਾਣਾ ਅਤੇ ਕਲਚਰ ਦੇ ਸਾਰੇ ਹਿੱਸੇ ਦਿਖਾਏ ਜਾਂਦੇ ਸੀ ਅਤੇ ਇੱਕ ਅੱਜ ਦਾ ਦੌਰ ਬੜਾ ਥੋੜ੍ਹਾ ਆਧੁਨਿਕ ਹੋ ਗਿਆ ਅਤੇ ਜਿਹੜਾ ਸਾਰਾ ਜਿਹੜਾ ਟੀ ਵੀ ਦੇ ਪ੍ਰੋਗਰਾਮ ਸੀ ਅਜੇ ਜਿਹੜੇ ਰੰਗ ਮੰਚ ਦੀ ਸਾਰੀ ਗਤੀਵਿਆਂ ਗਤੀਵਿਧੀਆਂ ਸੀ ਉਹ ਯੂਟਿਊਬ 'ਤੇ ਫਿਕਸ ਹੋਣ ਲੱਗੀਆਂ ਜਿਵੇਂ ਡੀ ਡੀ ਨੈਸ਼ਨਲ 'ਤੇ ਪਹਿਲਾਂ ਗਿੱਧਾ ਆਉਂਦਾ ਸੀ ਪੰਜਾਬੀ ਜਿਹੜੇ ਨੈਸ਼ਨਲ ਪੰਜਾਬੀ ਸੀ ਜਿਹੜੀ ਪੰਜਾਬੀ ਸੀ ਉਹਦੇ ਵਿੱਚ ਉਹਦੇ ਉੱਤੇ ਗਿੱਧਾ ਆਉਂਦਾ ਸੀ ਅਤੇ ਉਹ ਵੀ ਨਾਚ ਦਿਖਾਉਂਦੇ ਸੀ ਪੰਜਾਬ ਦਾ ਜਿਹੜਾ ਕਲਚਰ ਹੈ ਸੱਭਿਆਚਾਰ ਦਿਖਾਉਂਦੇ ਸੀ ਹੁਣ ਜਿਵੇਂ ਮਾਡਰਨਾਈਜੇਸ਼ਨ ਆਉਂਦਾ ਗਿਆ ਤਾਂ ਡਾਂਸ ਫਿੱਟ ਲਾਈਵ ਨਾਮ ਦਾ ਕੋਈ ਚੈਨਲ ਹੈ ਨੈਨੀ ਨੈਨਿਕਾ ਥਨਾਇਆ ਨਾਮ ਦਾ ਇੱਕ ਚੈਨਲ ਹੈ ਅਤੇ ਇੱਕ ਮਾਈਕਲ ਜੈਕਸਨ ਬਾਵਾਂ ਦੇ ਨਾਮ ਤੋਂ ਆਇਆ ਸੀ ਇੱਕ ਬੰਦਾ ਜਿਹੜਾ ਇੱਕ ਇਨਸਾਨ ਹੈ ਜਿਹੜਾ ਹੈ ਜਿਹੜਾ ਮਾਈਕਲ ਜ ਜੈਕਸਨ ਦੇ ਵਾਂਗੂ ਡਾਂਸ ਕਰਦਾ ਇਹੋ ਜਿਹੇ ਕਈ ਮਸ਼ਹੂਰ ਅਭਿਨੇਤਾ ਹੈ ਅਤੇ ਅਭਿਨੇਤਰੀਆਂ ਜਿਹੜੀ ਯੋਗਾ ਅਤੇ ਫਿਟਨੈਸ ਅਤੇ ਡਾਂਸ ਦੀ ਜਿਵੇਂ ਸ਼ਿਲਪਾ ਸ਼ੈਟੀ ਹੈ ਉਹ ਵੀ ਕਈ ਸਾਰੇ ਵੀਡੀਓ ਅਪਲੋਡ ਕਰਦੀ ਹੈ ਤਾਂ ਇਹ ਕਈ ਤਰੀਕੇ ਦੇ ਚੈਨਲ ਹੈ ਜਿਹੜੇ ਜਿਹਦੇ ਵਿੱਚ ਡਾਂਸ ਸਿਖਾਇਆ ਵੀ ਜਾਂਦਾ ਹੈ ਜਿਵੇਂ ਵੈਸਟਰਨ ਜ ਜਿਹੜਾ ਤਰੀਕਾ ਪੱਛਮੀ ਜਿਹੜਾ ਡਾਂਸ ਦਾ ਤਰੀਕਾ ਜਿਵੇਂ ਸਾਲਸਾ ਹੈ ਜਿਵੇਂ ਹੋਰ ਕਈ ਤਰੀਕੇ ਦੇ ਡਾਂਸ ਹੈ ਵੈਲੇ ਡਾਂਸ ਹੈ ਉਹ ਕਈ ਤਰੀਕੇ ਦੇ ਡਾਂਸ ਸਿਖਾਉਂਦੇ ਆ ਅਤੇ ਭਾਰਤੀ ਜਿਹੜੇ ਡਾਂਸ ਹੈ ਅਤੇ ਹੋਰ ਡੀ ਡੀ ਨੈਸ਼ਨਲ 'ਤੇ ਜਿਵੇਂ ਕੱਥਕ ਆਉਂਦਾ ਹਜੇ ਵੀ ਕੁਚੀ ਪੁੜੀ ਜਾਂ ਕਈ ਤਰੀਕੇ ਦੇ ਨ੍ਰਿੱਤ ਹੈ ਜਿਹੜੇ ਭਾਰਤ ਦੇ ਆਪਣੇ ਆਪ ਦੇ ਅਤੇ ਉਹਨਾਂ ਵਿੱਚ ਬੜੇ ਹੀ ਸੁੰਦਰ ਭਾਵ ਪੰਗੀਮਾ ਅਤੇ ਗਰੀਮਾ ਹੁੰਦੀ ਹੈ ਅਤੇ ਉਹ ਸਾਰਾ ਸਭ ਕੁਛ ਦਿਖਾਇਆ ਜਾਂਦਾ ਹੈ ਉਹ ਹਾਲੇ ਵੀ ਮੈਨੂੰ ਕਾਫ਼ੀ ਪਸੰਦ